ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਮਨਕੀਰਤ ਦੇ ਪਾਪਾ ਗੱਲ ਕਰਦੇ ਪਏ ਹਾਂਜੀ ਮੈ ਤੁਹਾਨੂੰ ਪੁੱਛਣਾ ਸੀ ਕਿ ਮਤਲਬ ਤਰਨ ਤਾਰਨ ਦੇ ਵਿੱਚ ਕਿਹੜੀ ਕਿਹੜੇ ਸਕੂਲ ਵਧੀਆ ਹੈ ਹਾਂਜੀ ਅਸੀਂ ਵੀ ਆਪਣਾ ਬੱਚਾ ਨਾ ਪੜ੍ਹਨੇ ਪਾਉਣਾ ਅਸੀਂ ਤਾਂ ਅਸੀਂ ਕਿਹਾ ਮਤਲਬ ਤੁਹਾਡੀ ਐਡਵਾਈਸ ਲੈ ਲਈਏ ਕਿ ਤਰਨ ਤਾਰਨ ਦੇ ਵਿੱਚ ਕਿਹੜੇ ਕਿਹੜੇ ਸਕੂਲ ਵਧੀਆ ਹੈ ਹਾਂਜੀ ਹਾਂਜੀ ਹਾਂਜੀ ਠੀਕ ਜਿਹੜਾ ਕੋਂਨਵੈਂਟ ਸਕੂਲ ਆ ਜਿੱਥੇ ਇੰਟਰਨੈਸ਼ਨਲ ਸਕੂਲ ਵੱਜਦਾ ਹੈ ਉਹਦੀ ਪੜ੍ਹਾਈ ਵੀ ਬਹੁਤ ਵਧੀਆ ਹੈ ਸਾਡਾ ਤਾਂ ਇਹ ਇਰਾਦਾ ਬਣ ਰਿਹਾ ਸੀ ਕਿ ਅਸੀਂ ਆਪਣੇ ਬੱਚੇ ਨੂੰ ਉੱਥੇ ਪੜ੍ਹਨੇ ਪਾਈਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਫਿਰ ਆਪਾਂ ਟਰਾਈ ਕਰਦੇ ਹਾਂ ਦੇਖਦੇ ਹਾਂ ਕੋਸ਼ਿਸ਼ ਕਰਕੇ ਕਿ ਕਿਹੜੇ ਵਿੱਚ ਐਡਮਿਸ਼ਨ ਹੁੰਦੀ ਆ ਹਾਂਜੀ ਓਕੇ ਜੀ ਓਕੇ